ਮੈਂ ਅੰਸ਼ੁਲ ਅਤੇ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਤੇ ਅੱਜ ਮੈਂ ਗੱਲ ਕਰਨ ਜਾ ਰਿਹਾ ਕਿ ਕੁਝ ਸਾਲ ਪਹਿਲਾਂ ਪੁਰਾਣੇ ਮੋਬਾਈਲ ਅਤੇ ਹੁਣ ਦੇ ਸਮਾਰਟ ਫੋਨਾਂ ਵਿੱਚ ਕੀ ਅੰਤਰ ਹੈ ਅਤੇ ਜੇ ਅਸੀਂ ਗੱਲ ਕਰੀਏ ਕੁਝ ਸਾਲ ਪਹਿਲਾਂ ਦੀ ਤਾਂ ਜੋ ਸਾਡੇ ਪੁਰਾਣੇ ਮੋਬਾਇਲ ਸੀ ਜੋ ਬਟਨਾ ਵਾਲੇ ਸਨ ਉਹ ਕਾਫ਼ੀ ਵੱਖਰੇ ਡਿਜ਼ਾਇਨ ਦੇ ਸਨ ਇੱਕ ਤਾਂ ਉਸ ਤੋਂ ਬਾਅਦ ਜੇ ਅਸੀਂ ਵੇਖੀਏ ਕਿ ਉਹ ਕਾਫ਼ੀ ਮਜ਼ਬੂਤ ਸਨ ਜਿਵੇਂ ਕਿ ਉਸ ਦਾ ਇੱਕ ਇਹ ਫ਼ਾਇਦਾ ਸੀ ਕਿ ਉਸਦੀ ਰੇਡੀਏਸ਼ਨ ਬਹੁਤ ਘੱਟ ਸੀ ਅਤੇ ਉਹ ਕੰਮ ਤਾਂ ਆਉਂਦੇ ਸੀ ਪਰ ਜੇ ਗੱਲ ਕਰੀਏ ਅੱਜ ਦੇ ਸਮਾਰਟ ਫੋਨਾਂ ਦੀ ਇਸ ਦੇ ਉਸ ਤੋਂ ਜ਼ਿਆਦਾ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਪੁਰਾਣੇ ਬਟਨਾ ਵਾਲੇ ਫੋਨ 'ਚ ਕੈਮਰੇ ਦਾ ਫੀਚਰ ਨਹੀਂ ਹੁੰਦਾ ਸੀ ਅਤੇ ਅੱਜ ਕੱਲ੍ਹ ਦੇ ਸਮਾਰਟ ਫੋਨਾਂ ਵਿੱਚ ਕੈਮਰੇ ਦਾ ਫੀਚਰ ਵੀ ਆ ਗਿਆ ਅਤੇ ਕੁਝ ਸਾਲ ਪਹਿਲਾਂ ਤਾਂ ਉਹ ਫੋਨਾਂ ਵਿੱਚ ਨੈਟਵਰਕ ਵੀ ਨਹੀਂ ਹੁੰਦਾ ਸੀ ਮਤਲਬ ਕਿ ਇੰਟਰਨੈਟ ਚਲਾਉਣ ਦੀ ਸਹੂਲਤ ਨਹੀਂ ਹੁੰਦੀ ਸੀ ਅਤੇ ਅੱਜ ਕੱਲ੍ਹ ਤਾਂ ਇੰਟਰਨੈਟ ਆਮ ਹਰ ਫੋਨ 'ਚ ਮਿਲ ਰਿਹਾ ਪਰ ਜੋ ਪੁਰਾਣੇ ਫੋਨ ਸੀ ਉਹ ਜੋ ਜਾਨਵਰਾਂ ਕਰ ਜਾਨਵਰ ਜਾਨਵਰਾਂ ਲਈ ਮਤਲਬ ਰੇਡੀਏਸ਼ਨ ਨਹੀਂ ਛੱਡਦੇ ਸੀ ਲੇਕਿਨ ਜੋ ਅੱਜ ਕੱਲ੍ਹ ਦੇ ਸਮਾਰਟ ਫੋਨ ਹੈਗੇ ਨੇ ਨਾ ਇਹ ਤਾਂ ਬਹੁਤ ਜ਼ਿਆਦਾ ਰੇਡੀਏਸ਼ਨ ਛੱਡਦੇ ਨੇ ਜੋ ਕਿ ਸਾਡੇ ਲਈ ਤੇ ਅਤੇ ਜਾਨਵਰ ਲਈ ਬਹੁਤ ਹਾਨੀਕਾਰਕ ਹੈ ਮੈਨੂੰ ਲੱਗਦਾ ਕਿ ਸਮਾਰਟ ਫੋਨ ਦੇ ਫ਼ਾਇਦੇ ਤਾਂ ਬੜੇ ਨੇ ਪਰ ਇਸ ਦੇ ਨਾਲ ਨਾਲ ਇਸ ਦੇ ਨੁਕਸਾਨ ਵੀ ਬੜੇ ਨੇ ਜੋ ਕਿ ਮੇਰੇ ਹਿਸਾਬ ਨਾਲ ਪਿਛਲੇ ਪੁਰਾਣੇ ਮੋਬਾਈਲਾਂ ਦੀ ਘੱਟ ਸੀ ਅਤੇ ਇੱਕ ਚੀਜ਼ ਨੋਟ ਕਰੀਏ ਤਾਂ ਪੁਰਾਣੇ ਮੋਬਾਈਲ 'ਚ ਫੀਚਰ ਕਾਫ਼ੀ ਘੱਟ ਸੀ ਅਤੇ ਸਮਾਰਟ ਫੋਨ ਵਿੱਚ ਬਹੁਤ ਕੁਝ ਜ਼ਿਆਦਾ ਅਤੇ ਜੇ ਮੈਂ ਹੁਣ ਦੀ ਗੱਲ ਕਰਾਂ ਤਾਂ ਸਮਾਰਟ ਫੋਨ ਮੈਂ ਤਾਂ ਚਲਾਉਦਾ ਅਤੇ ਅੱਜ ਕੱਲ੍ਹ ਦੇ ਜਮਾਨੇ ਦੀ ਗੱਲ ਕਰੀਏ ਤਾਂ ਮੈਂ ਜੀਓ ਦਾ ਸਿੰਮ ਵਰਤਦਾ ਮੇਰੇ ਖਿਆਲ 'ਚ ਅੱਜ ਕੱਲ੍ਹ ਸਾਰੇ ਜੀਓ ਦਾ ਸਿੰਮ ਹੀ ਵਰਤਦੇ ਨੇ ਅਤੇ ਜੇ ਮੈਂ ਗੱਲ ਕਰਾਂ ਡਾਟਾ ਪੈਕ ਦੀ ਤਾਂ ਮੇਰੇ ਕ ਖਿਆਲ 'ਚ ਲਗਭਗ ਸੌ ਕੁ ਰੁਪਏ ਦਾ ਖਰਚਾ ਹੋ ਹੀ ਜਾਊਗਾ ਮਹੀਨਾ ਕੁ ਮਹੀਨੇ ਵਾਸਤੇ ਡਾਟ ਡਾਟਾ ਪੈਕ 'ਤੇ ਅਤੇ ਬਾਈ ਚਾਂਸ ਜੇ ਮਤਲਬ ਇੱਕ ਦਿਨ ਦਾ ਜਾਂ ਮਤਲਬ ਡਾਟਾ ਪੈਕ ਖਤਮ ਹੋ ਜਾਂਦਾ ਤਾਂ ਅਸੀਂ ਉਸਨੂੰ ਐਡੀਸ਼ਨਲ ਐਡ ਔਨ ਕਰਕੇ ਡਾਟਾ ਰੀਚਾਰਜ ਕਰ ਸਕਦੇ ਹਾਂ ਅਤੇ ਇਹ ਸੀ ਕੁਝ ਸਹੂਲਤਾਂ ਅਤੇ ਫੋਨਾਂ ਦੇ ਕੁਝ ਨੁਕਸਾਨ ਜੋ ਕਿ ਪੁਰਾਣੇ ਮੋਬਾਇਲ ਅਤੇ ਅੱਜ ਦੇ ਸਮਾਰਟ ਫੋਨਾਂ ਦੇ ਵਿੱਚ ਅੰਤਰ ਦੱਸਦਾ ਹੈ